ਸਪੀਕ ਆਊਟ ਦਾ ਫਲੋਇੰਗ ਨੇਮਸ ਓਫ ਸਵੀਟਸ ਔਰ ਪੇਸਟਰਾਈਸ ਹੀਟਸ ਫੀ ਐਫ ਈ ਫੀ ਫੀਰਾਰੂ ਪੋਕਟ ਕੌਫੀ ਕੈਂਡਰ ਹੈਪੀ ਹਿਪੂ ਕੈਪਟਵੈਰੀ ਪਿਕਨਿਕ